ਮੈਂ ਬਚਪਨ ਤੋਂ ਡਰਾਇੰਗ ਕਰ ਰਿਹਾ ਅਤੇ ਮੈਨੂੰ ਜਿਸ ਆਰਟਿਸਟ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਹੈਗਾ ਐਨਰੀ ਰੂਸੋ ਬਹੁਤ ਵਧੀਆ ਉਹਨਾਂ ਦਾ ਆਰਟ ਵਰਕ ਮੈਨੂੰ ਲੱਗਦਾ ਉਹਨਾਂ ਜਿਹੜੀ ਉਹਨਾਂ ਦੀ ਪੇਂਟਿੰਗਸ ਹੈਗੀਆਂ ਡਰਾਇੰਗ ਜਾਂ ਆਰਟ ਵਰਕਸ ਹੈਗੇ ਨੇ ਉਹਨਾਂ ਵਿੱਚ ਉਹਨਾਂ ਨੇ ਕਾਫੀ ਜ਼ਿਆਦਾਤਰ ਜੰਗਲ ਦੇ ਸੀਨਾਂ ਨੂੰ ਦਰਸ਼ਾਇਆ ਹੈਗਾ

ਮੈਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਉਹਨਾਂ ਦੀ ਆਰਟ ਵਰਕਸ ਕਿਉਂਕਿ ਉਹਨਾਂ ਦੇ ਆਰਟ ਵਰਕਸ 'ਚ ਪਤਾ ਚਲਦਾ ਕੀ ਕੁਝ ਬਣਾਇਆ ਕਿਸੇ ਨੇ ਇੰਨਾਂ ਵਧੀਆ ਲੱਗਦਾ ਉਹ ਅੱਖਾਂ ਨੂੰ ਇਸ ਤਰ੍ਹਾਂ ਦੇ ਮੈਨੂੰ ਪੁਰਾਣੀਆਂ ਆਰਟ ਵਰਕਾਂ ਦੇਖਣ 'ਚ ਬਹੁਤ ਚੰਗਾ ਲੱਗਦਾ ਹੈ ਪਰ ਔਰ ਜਿਹੜਾ ਮੋਡਨ ਆਰਟ ਵਰਕ ਆਇਆ ਨਾ ਸ਼ੇਡਿੰਗ ਵਗੈਰਾ ਪੈਨਸਿਲ ਵਗੈਰਾ ਪੈਨਸਿਲ ਸ਼ੇਡਿੰਗ ਐਟਸੈਕਟਰਾ ਉਹ ਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਅਤੇ ਮੈਂ ਆਪੇ ਜਿਹੜਾ ਕਰਨਾ ਉਹ ਮੈਂ ਕਰਦਾ ਵਾਟਰ ਕਲਰ ਪੇਂਟਿੰਗ ਓਇਲ ਪੇਸਟਰ ਪੇਂਟਿੰਗਜ਼ ਠੀਕ ਹੈ ਜੀ ਅਤੇ ਮੈਂ ਡਰਾਇੰਗ ਕਰਨਾ ਇਮੈਜਿਨ ਕਰਨਾ ਕੋਈ ਦ੍ਰਿਸ਼ ਅਤੇ ਉਹਨੂੰ ਆਪਣੇ ਪੇਪਰ 'ਚ ਉਤਾਰ ਦਿੰਦਾ ਕਦੇ ਕੋਈ ਜਾਨਵਰ ਹੋ ਗਿਆ ਕਦੇ ਕੁਛ ਹੋ ਗਿਆ ਆਰਟ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਲਈ ਉਹਨੂੰ ਸਿਰਫ ਕਲਮ ਤੋਂ ਉਤਾਰਿਆ ਜਾ ਸਕਦਾ ਕਿਸੇ ਕਾਗਜ਼ 'ਤੇ ਹੈਨਰੀ ਰੂਸੋ ਦੀ ਜੰਗਲ ਵਾਲੀਆਂ ਪੇਂਟਿੰਗਾਂ ਤਾਂ ਬਹੁਤ ਹੀ ਵਧੀਆ ਹੁੰਦੀਆਂ ਨੇ ਅਤੇ ਇੱਕ ਔਰ ਆਰਟਿਸਟ ਨੇ ਪੈਬਲੋ ਬਿਕਾਸੋ ਕੰਨਾਂ ਨੂੰ ਹੱਥ ਲਾਇਆ ਉਹਨਾਂ ਦੇ ਨਾਂ ਸੋਚ ਕੇ ਵੀ ਇੰਨੇ ਵਧੀਆ ਆਰਟਿਸਟ ਨਾ ਕਦੇ ਹੋਏ ਨੇ ਅਤੇ ਨਾ ਕਦੇ ਹੋਣਗੇ ਉਨ੍ਹਾਂ ਦੀ ਹਰ ਆਰਟ ਵਰਕ ਦੇ ਪਿੱਛੇ ਕੁਛ ਨਾ ਕੁਛ ਮਤਲਬ ਹੁੰਦਾ ਹੈਗਾ ਕੁਝ ਨਾ ਕੁਝ ਮਤਲਬ ਨਿਕਲਦਾ ਹੀ ਹੈ ਕੋਈ ਡੀਪ ਜਿਹਾ ਮਤਲਬ ਹੁੰਦਾ ਹੈਨਰੀ ਰੂਸੋ ਪੇਬਲੋ ਬਿਕਾਸੋ ਕਿੰਨੇ ਹੀ ਆਰਟਿਸਟ ਨੇ ਕਿੰਨੇ ਵਧੀਆ ਅਤੇ 'ਚ ਤਾਂ ਕਾਫੀ ਸਾਰੀ ਯੂਟੀਊਬ 'ਤੇ ਵੀ ਆਰਟਿਸਟ ਹੈਗੇ ਨੇ ਉਹਨਾਂ ਨੂੰ ਦੇਖ ਕੇ ਵੀ ਆਪਣੀ ਪੇਂਟਿੰਗਾਂ ਨੂੰ ਹੋਰ ਵਧੀਆ ਕਰਨ ਦਾ ਮਨ ਕਰਦਾ ਆਪਣੀ ਡਰਾਇੰਗ ਨੂੰ ਹੋਰ ਵਧੀਆ ਕਰਨ ਦਾ ਮਨ ਕਰਦਾ ਸੌਰਵ ਜੋਸ਼ੀ ਹੋ ਗਿਆ ਵਲੋਗਰ ਵਲੋਗਰ ਹੈਗਾ ਪਰ ਉਹਨਾਂ ਦਾ ਆਰਟ ਚੈਨਲ ਹੈਗਾ ਬਹੁਤ ਵਧੀਆ ਉਹ ਡਰੋ ਡਰਾਇੰਗ ਕਰਦੇ ਨੇ ਇਸ ਤਰ੍ਹਾਂ ਹੀ ਆ